ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਅਸੀਂ ਮਲੋਹਤਰਾ ਜਿਊਲਰ ਤੋਂ ਬੋਲ ਰਹੇ ਆ ਤੁਸੀਂ ਕੌਣ

ਸਾਡੀ ਪਤਾ ਸਾਰੀ ਟਰਡੀਸ਼ਨਲ ਪੰਜਾਬੀ ਜਿਊਲਰੀ ਹੈਗੀ ਹੈ ਸਾਡੇ ਕੋਲ ਸੱਗੀ ਫੁੱਲ ਸਭ ਕੁਛ ਹੈਗਾ ਤੁਸੀਂ ਜਿੱਦਾਂ ਦਾ ਕਲਰ ਜਿੱਦਾਂ ਦੀ ਚੋਇਸ ਤੁਹਾਡੀ ਹੋਵੇਗੀ ਤੁਸੀਂ ਸਾਡੀ ਦੁਕਾਨ 'ਤੇ ਆ ਸਕਦੇ ਹੋ ਅਤੇ ਸਾਡੇ ਕੋਲ ਤਰ੍ਹਾਂ ਦੇ ਹਲਦੀ ਦੇ ਅਲੱਗ ਵਿਆਹ ਦੇ ਅਲੱਗ ਅਤੇ ਜਿਹੜੀ ਸਾਡੀ ਵਿਰਾਸਤ ਨਾਲ ਜੁੜੀ ਜਿਊਲਰੀ ਹੈ ਨਾ ਉਹਨਾਂ ਨੂੰ ਅਸੀਂ ਕਾਪੀ ਕਰਕੇ ਉਹੀ ਚੀਜ਼ਾਂ ਅਸੀਂ ਜਿਊਲਰੀ ਦੇ ਡਿਜ਼ਾਇਨ ਵਿੱਚ ਕਰਾਏ ਆ ਤੁਸੀਂ ਜਿਹੜੇ ਰੰਗ ਦਾ ਲੱਗ ਬੋਲੋ ਜਿਹੜਾ ਡਿਜ਼ਾਇਨ ਦੱਸੋ ਸਾਨੂੰ ਅਸੀਂ ਤੁਹਾਨੂੰ ਉੱਦਾਂ ਦਾ ਬਤੌਰ ਬਣਾ ਕੇ ਦੇਵਾਂਗੇ ਅਤੇ ਸਾਨੂੰ ਥੋੜ੍ਹੇ ਦਿਨ ਦਾ ਟਾਈਮ ਚਾਹੀਦਾ ਘੱਟ ਤੋਂ ਘੱਟ ਇਕ ਹਫ਼ਤਾ ਚਾਹੀਦਾ ਸਾਡੇ ਕੋਲ ਨੱਥ ਹੈ ਸਾਡੇ ਕੋਲ ਟਿੱਕਾ ਹੈਗਾ ਸੱਗੀ ਫੁੱਲ ਹੈਗੀ ਹੈ ਜਿਹੜੀ ਜਿਹੜੀ ਤੁਹਾਨੂੰ ਚੀਜ਼ਾਂ ਚਾਹੀਦੀਆਂ ਸਾਡਾ ਦੁਕਾਨ ਹਾਂਜੀ ਤੁਹਾਡੇ ਕੋਲ ਨਾ ਰੈਂਟ 'ਤੇ ਵੀ ਮਿਲਦੀ ਹੈ ਅਤੇ ਬਤੌਰ ਤੁਸੀਂ ਖਰੀਦ ਵੀ ਸਕਦੇ ਹੋ ਜੇ ਰੈਂਟ 'ਤੇ ਲੈਂਦੇ ਹੋ ਤਾਂ ਤੁਹਾਨੂੰ ਕੁਝ ਪੈਸੇ ਕੱਟ ਕੇ ਵਾਪਸ ਲੈ ਜਾਗੇ ਨਹੀਂ ਤਾਂ ਤੁਸੀਂ ਖਰੀਦ ਸਕਦੇ ਹੋ ਅਤੇ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਤੁਸੀਂ ਸਾਡੇ ਦੁਕਾਨ 'ਤੇ ਆਓ ਨਾਲੇ ਤੁਸੀਂ ਮੈਚਿੰਗ ਕੱਪੜੇ ਲੈ ਕੇ ਆਓ ਅਸੀਂ ਕਸਟਮਰ ਦੀ ਸਪੈਸ਼ਲ ਰੱਖਿਆ ਹੋਇਆ ਹੈ ਤਾਂ ਕੀ ਤੁਸੀਂ ਆਪਣੇ ਡਿਜ਼ਾਇਨ ਖ਼ੁਦ ਵਰਤ ਸਕਦੇ ਹੋ ਤੇ ਤੁਸੀਂ ਲਾ ਕੇ ਦੇਖ ਸਕਦੇ ਹੋ ਹੋਰ ਤੁਹਾਨੂੰ ਕੀ ਚਾਹੀਦੇ ਆ ਅਤੇ ਤੁਹਾਨੂੰ ਕਿਸੇ ਵੀ ਟਾਈਮ ਆਓ ਸਾਡੇ ਕੋਲ ਪੰਜਾਬੀ ਲਈ ਸਪੈਸ਼ਲ ਸਿਖਰਪੁਰੀ ਨੱਥ ਹੁੰਦੀ ਹੈ ਜਿਹੜੀ ਪੰਜਾਬੀ ਬਰਾਈਟ ਪਹਿਨਦੀਆਂ ਸ਼ਿਖਰਪੁਰੀ ਨਕ ਨੱਥ ਹੁੰਦੀ ਹੈ ਜਿਹੜੀ ਪੰਜਾਬੀ ਬਰਾਈਡ ਪਾਂਦੀਆਂ ਉਹ ਸਪੈਸ਼ਲ ਕਲਰ ਉਸੇ ਦਾ ਮਿਲਦਾ ਜਿਹੜਾ ਤੁਹਾਡਾ ਲਹਿੰਗਾ ਹੋਵੇ ਜਾਂ ਤੁਹਾਡਾ ਸੂਟ ਹੋਵੇ ਉਹਦੇ ਨਾਲ ਫਬਦਾ ਤਾਂ ਬਹੁਤ ਹੀ ਵਧੀਆ ਸਾਡੇ ਕੋਲ ਡਿਜ਼ਾਇਨ ਹੈ ਪੂਰੇ ਇੰਡੀਆ ਵਿੱਚ ਅਸੀਂ ਮੰਨੇ ਹੋਏ ਆ ਇਸਨੂੰ ਹਾਂਜੀ ਸਾਡੇ ਕੋਲ ਹਾਂਜੀ ਹਾਂਜੀ ਸਾਡੇ ਕੋਲ ਟਰੈਡੀਸ਼ਨਲ ਹੈਗਾ ਸਭ ਕੁਝ ਜਿਹੜਾ ਸਾਡੀ ਪੰਜਾਬੀ ਵਿਰਾਸਤ ਨੂੰ ਅੱਗੇ ਰੱਖਦਾ ਅਤੇ ਪੰਜਾਬੀ ਵਿਰਾਸਤ ਨਾਲ ਸਾਨੂੰ ਜੋੜ ਕੇ ਰੱਖਦਾ ਅਤੇ ਸਿੱਖ ਲਈ ਇੱਥੇ ਸਾਡੇ ਕੋਲ ਸਲਵਾਰ ਕਮੀਜ਼ ਅਤੇ ਲਹਿੰਗੇ ਦੇ ਨਾਲ ਜਿਹੜੇ ਸਪੈਸ਼ਲ ਅਨੰਦ ਕਾਰਜ ਵਿੱਚ ਪਾਏ ਜਾਂਦੇ ਹਨ ਉਹ ਵੀ ਸਾਡੇ ਕੋਲ ਹੈਗੇ ਅਤੇ ਅਤੇ ਮੈਂ ਤੁਹਾਨੂੰ ਇਹ ਕਹਾਂਗਾ ਕਿ ਕਿਸੇ ਵੀ ਟਾਈਮ ਤੁਸੀਂ ਆਇਓ ਅਤੇ ਅਸੀਂ ਅਸੀਂ ਇਕ ਦਿਨ ਪਹਿਲਾਂ ਫੋਨ ਕਰ ਦਿਓ ਅਸੀਂ ਤੁਹਾਨੂੰ ਪੱਕਾ ਉਹਦੇ ਲਈ ਕਰਾਂਗੇ ਅਸੀਂ ਔਨਲਾਈਨ ਹਾਂਜੀ ਅਸੀਂ ਤੁਹਾਨੂੰ ਆਨਲਾਈਨ ਵੀ ਭੇਜ ਦੇਵਾਂਗੇ ਧੰਨਵਾਦ ਤੁਸੀਂ ਜ਼ਰੂਰ ਆਇਓ